ਸਾਡੇ ਜ਼ਿਲ੍ਹੇ ਵਿੱਚ ਵੈਸੇ ਤਾਂ ਬਹੁਤ ਸਾਰੇ ਪੂਜਾ ਸਥਾਨ ਹਨ ਜਿੱਥੇ ਬਹੁਤ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਇਕੱਠੇ ਮਿਲ ਕੇ ਹਰੇਕ ਤਿਉਹਾਰ ਨੂੰ ਮਨਾਉਂਦੇ ਹਨ ਪਰ ਸਾਡੇ ਜ਼ਿਲ੍ਹੇ ਵਿੱਚ ਇੱਕ ਅਜਿਹਾ ਗੁਰਦੁਆਰਾ ਹੈ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜਿੱਥੇ ਵਿਸਾਖੀ ਦਾ ਮੇਲਾ ਹਰ ਸਾਲ ਤੇਰ੍ਹਾਂ ਅਪ੍ਰੈਲ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਜਿੱਥੇ ਅਲੱਗ ਅਲੱਗ ਧਰਮਾਂ ਦੇ ਲੋਕ ਆਉਂਦੇ ਹਨ ਅਤੇ ਬੇਝਿਜਕ ਉੱਥੇ ਮੱਥਾ ਟੇਕਦੇ ਹਨ ਲੰਗਰ ਛੱਕਦੇ ਹਨ ਇਸ਼ਨਾਨ ਕਰਦੇ ਹਨ ਅਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣਦੇ ਹਨ ਅਤੇ ਇਸ ਮੇਲੇ ਵਿੱਚ ਬਹੁਤ ਸਾਰੀਆਂ ਲੋਕ ਖੇਡਾਂ ਜਿਵੇਂ ਕਿ ਕਬੱਡੀ ਵਗੈਰਾ ਆਦਿ ਵੀ ਖੇ ਦੇਖਣ ਨੂੰ ਮਿਲਦੀਆਂ ਹਨ ਲੋਕ ਭੰਗੜਾ ਭੰਗੜਾ ਗਿੱਧਾ ਇਹ ਸਾਰੇ ਜਿਹੜੇ ਕਿ ਉੱਥੇ ਲੋਕ ਜਿਹੜੇ ਨਾਚ ਆ ਦੇਖਣ ਨੂੰ ਮਿਲਦੇ ਹਨ ਅਤੇ ਇੱਥੇ ਸਾਡੇ ਬਹੁਤ ਸਾਰੀਆਂ ਪਰੰਪਰਾਵਾਦੀ ਜੋ ਗੱਲਾਂ ਹੈ ਪੁਰਾਣੇ ਸੱਭਿਆਚਾਰਾਂ ਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਜੋ ਛੋਟੇ ਬੱਚੇ ਹਨ ਉਹਨਾਂ ਨੂੰ ਵੀ ਆਪਣਾ ਪੁਰਾਣਾ ਪੰਜਾਬ ਦਾ ਇਤਿਹਾਸ ਜਾਣਨ ਨੂੰ ਮਿਲਦਾ ਹੈ ਕਿ ਸਾਡੇ ਪੁਰਾਣੇ ਪੰਜਾਬ ਵਿੱਚ ਭੰਗੜਾ ਗਿੱਧਾ ਕਬੱਡੀ ਵਗੈਰਾ ਆਦਿ ਕੀ ਹੁੰਦੇ ਸਨ ਅਤੇ ਇਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੁੰਦਾ ਹੈ